ਹਾਂ ਛੋਟੇ ਉਦਯੋਗਾਂ ਛੋਟੇ ਕਿਸਾਨਾਂ ਅਤੇ ਮਹਿਲਾ ਉਦਯੋਗਪਤੀਆਂ ਆਦਿ ਲਈ ਵਿਸ਼ੇਸ਼ ਸਕੀਮਾਂ ਉਪਲੱਬਧ ਹਨ ਜਿਵੇਂ ਕਿ ਛੋਟੇ ਉਦਯੋਗਾਂ ਦੇ ਲਈ ਮੁਦਰਾ ਯੋਜਨਾ ਸਕੀਮ ਛੋਟੇ ਕਿਸਾਨਾਂ ਦੇ ਲਈ ਨੈਸ਼ਨਲ ਵਿੱਕੀਪਿੰਗ ਐਂਡ ਹਨੀ ਸਕੀਮ ਮਹਿਲਾ ਦੇ ਲਈ ਅੰਨਪੂਰਣਾ ਅਤੇ ਮਹਿਲਾ ਉਦਿਆਨ ਨਿਧੀ ਸਕੀਮ ਆਦਿ ਸਕੀਮਾਂ ਚਲਾਈਆਂ ਗਈਆਂ ਹਨ ਗਵਰਮੈਂਟ ਇਹਨਾਂ ਸਕੀਮਾਂ ਦੇ ਥਰੂ ਛੋਟੇ ਉਦਯੋਗਾਂ ਛੋਟੇ ਕਿਸਾਨਾਂ ਅਤੇ ਮਹਿਲਾ ਉਦਯੋਗਪਤੀਆਂ ਆਦਿ ਸੈਕਟਰਸ ਦੇ ਵਿੱਚ ਹੋਰ ਡਿਵੈਲਪਮੈਂਟ ਕਰ ਰਹੇ ਹਨ ਮੇਰੇ ਮਾਤਾ ਜੀ ਖੁਦ ਅੰਨਪੂਰਣਾ ਸਕੀਮ ਰਾਹੀਂ ਆਪਣਾ ਬਿਜਨਸ ਚਲਾ ਰਹੇ ਹਨ ਉਹ ਅੰਨਪੂਰਣਾ ਸਕੀਮ ਦੇ ਰਾਹੀਂ ਆਪਣਾ ਲੰਚ ਬਿਜਨਸ ਚਲਾ ਰਹੇ ਹਨ ਜਿਸ ਦੇ ਥਰੂ ਉਹ ਇੱਕ ਵਧੀਆ ਅਰਨਿੰਗ ਵੀ ਕਰ ਰਹੇ ਹਨ ਅਤੇ ਇਸ ਦੇ ਥਰੂ ਉਹਨਾਂ ਦੀ ਖੁਦ ਦੀ ਵੀ ਡਿਵੈਲਪਮੈਂਟ ਹੋ ਰਹੀ ਹੈ